ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਰੈਸਟੋਰੈਂਟ ਤੋਂ ਹੁਣ ਹੀ ਇੱਕ ਔਡਰ ਕੀਤਾ ਸੀ ਅਤੇ ਮੈਨੂੰ ਉਸ ਔਡਰ ਦੀ ਰਸੀਦ ਜਲਦ ਤੋਂ ਜਲਦ ਚਾਹੀਦੀ ਹੈ ਮੈਂ ਕੁਝ ਵੇਖਣਾ ਹੈ ਅਤੇ ਤੁਸੀਂ ਜੇ ਉਸ ਨਾਲ ਮੈਨੂੰ ਆਪਣਾ ਮੈਨਯੂ ਕਾਰਡ ਵੀ ਭੇਜ ਸਕਦੇ ਹੋ ਤਾਂ ਤੁਹਾਡੀ ਬਹੁਤ ਹੀ ਜ਼ਿਆਦਾ ਸਹਾਇਤਾ ਹੋਵੇਗੀ ਮੇਰੇ ਵੱਲ ਨੂੰ ਮੈਂ ਕ੍ਰਿਪਾ ਕਰਦਾ ਹਾਂ ਕਿ ਤੁਸੀਂ ਜਲਦ ਤੋਂ ਜਲਦ ਮੈਨੂੰ ਇੱਕ ਰਸੀਦ ਜਾਂ ਮੈਨਯੂ ਕਾਰਡ ਮੇਰੇ ਐਪ 'ਤੇ ਹੀ ਭੇਜ ਦੇਵੋ ਮੈਂ ਐਪ 'ਤੇ ਵੀ ਦੋ ਤਿੰਨ ਵਾਰ ਈਮੇਲਾਂ ਪਾਈਆਂ ਹਨ ਪਰ ਕਿਸੇ ਦਾ ਕੋਈ ਜਵਾਬ ਨਹੀਂ ਆਇਆ ਅਤੇ ਕ੍ਰਿਪਾ ਕਰਕੇ ਤੁਹਾਨੂੰ ਬਹੁਤ ਸਾਰਾ ਕ੍ਰਿਪਾ ਹੈ ਕਿ ਜਲਦ ਤੋਂ ਜਲਦ ਮੈਨੂੰ ਭੇਜੀ ਜਾਵੇ ਕਿਉਂਕਿ ਮੈਨੂੰ ਬਹੁਤ ਹੀ ਕੁਝ ਜ਼ਰੂਰੀ ਕੰਮ ਹੈ ਅਤੇ ਤੁਹਾਡੇ ਔਡਰ ਦੇ ਸਵਾਦ ਬਹੁਤ ਵਧੀਆ ਹੈ ਬਸ ਤੁਹਾਡੇ ਰੇਟ ਬਹੁਤ ਜ਼ਿਆਦਾ ਹਨ ਅਤੇ ਕ੍ਰਿਪਾ ਕਰ ਕੇ ਥੋੜ੍ਹਾ ਜਿਹਾ ਰੇਟਾਂ ਵੱਲ ਧਿਆਨ ਦੇਵੋ ਖ਼ਾਸ ਕਰ ਬਟਰ ਨਾਨ ਦੇ ਰੇਟ ਬਹੁਤ ਜ਼ਿਆਦਾ ਹਨ ਬਾਹਰ ਕਿਤੇ ਹੋਰ ਖਾਈਏ ਤਾਂ ਤੀਹ ਤੋਂ ਪੈਂਤੀ ਦੇ ਵਿੱਚ ਆ ਜਾਂਦੇ ਹਨ ਪਰ ਤੁਹਾਡਾ ਬਟਰ ਨਾਨ ਦਾ ਰੇਟ ਹੀ ਪੰਜਾਹ ਰੁਪਏ ਹੈ ਬਾਕੀ ਸਵਾਦ ਵਿੱਚ ਕੋਈ ਦਿੱਕਤ ਨਹੀਂ ਹਨ ਬਸ ਰੇਟ ਬਹੁਤ ਜ਼ਿਆਦਾ ਹਨ ਕੁਝ ਗਰੀਬ ਪਰਿਵਾਰ ਦੇ ਲੋਕ ਇਸ ਨੂੰ ਨਹੀਂ ਖਾ ਸਕਦੇ ਤਾਂ ਥੋੜ੍ਹਾ ਜਿਹਾ ਰੇਟ ਨੂੰ ਘੱਟ ਕਰੋ ਤਾਂ ਜੋ ਸਭ ਇਸ ਦਾ ਆਨੰਦ ਲੈ ਸਕਣ ਧੰਨਵਾਦ